ਅਸੀਂ ਛੋਟੇ ਹੁੰਦੇ ਵੱਡੀ ਮੂਰਤੀ ਦੇ ਰੂਪ ਵਿੱਚ ਰਾਵਣ ਦੀ ਮੂਰਤੀ ਬਣਾਉਂਦੇ ਹੁੰਦੇ ਸੀ ਜੋ ਕਿ ਦੁਸਹਿਰੇ ਵਾਲੇ ਦਿਨ ਸ਼ਾਮ ਨੂੰ ਫੂਕ ਦਿੰਦੇ ਸੀ ਉਸ ਵਿੱਚ ਜਿਹੜੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਹੁੰਦੀਆਂ ਸੀ ਰਾਵਣ ਦੀ ਮੂਰਤੀ ਵਿੱਚ ਭਰਨੇ ਲਈ ਪਰਾਲੀ ਉਹ ਸਮੇਂ ਮਿਲਦੀ ਘੱਟ ਹੁੰਦੀ ਹੈ ਕਿ ਕਿਉਂ ਪਰਾਲੀ ਦਾ ਸੀਜਨ ਨਹੀਂ ਜ਼ੀਰੀ ਦਾ ਸੀਜ਼ਨ ਨਹੀਂ ਹੁੰਦਾ ਕਿ ਪਰਾਲੀ ਐ ਇਸ ਐਨੀ ਮਿਲ ਸਕੇ ਉਸ ਤੋਂ ਬਾਅਦ ਘਰ ਦੇ ਸਾਨੂੰ ਪੈਸੇ ਨਹੀਂ ਤੇ ਦਿੰਦੇ ਹੁੰਦੇ ਕਿ ਬੰਬ ਫਿੱਟ ਕਰ ਸਕੀਏ ਜਿਹੜੇ ਬੰਬਾਂ ਦੇ ਕਹਿੰਦੇ ਤੁਸੀਂ ਜਲ ਜਾਵੋਂਗੇ ਇਸ ਕਰਕੇ ਇਸ ਇੱਦਾਂ ਦੀਆਂ ਜਿਹੜੀਆਂ ਚੁਣੌਤੀਆਂ ਆਉਂਦੀਆਂ ਹੁੰਦੀਆਂ ਸੀ ਸਾਨੂੰ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਸੀ